ਫਰੀਜ਼ ਡਾਇਰਸ ਸੋਇਆ ਪਨੀਰ ਇਜ਼ ਐਨ ਅਦਰ ਵਰਡ ਫਰੋਮ ਟੋਫੋ ਵਿਚ ਇਜ ਮੇਡ ਫਰੋਮ ਦੇਅਰ ਓਫ ਸੋਇਆ ਮਿਲਕ ਵੇਅਰ ਐਜ ਪਨੀਰ ਇਜ਼ ਮੇਡ ਫਰੋਮ ਕੋਡਿਕ ਐਨ ਈਮਨ ਵੇਸਟ ਮਿਲਕ ਦੈਨ ਦਾ ਸਵੀਟ ਪਟੈਟੋ ਇਜ ਟੈਕ ਦੀ ਸਵੀਟ ਟੇਸਟਿੰਗ ਰੂਟ ਵੈਜੀਟੇਬਲਜ ਇਟ ਹੈਜ਼ ਥਿੰਨ ਬਰਾਊਨ ਆਊਟਰ ਸਕਿੰਨ ਵਿਚ ਰਾਈਟ ਕੋਲੋਜ ਪਲੀਸ਼ ਮੋਸਟ ਕੋਮਲੀ ਔਰੇਂਜ ਬਟ ਦਾ ਅਦਰ ਵੀਗੀ ਇਨਸ ਇੰਨਕਲਿਊਡ ਵਾਈਟ ਪਰਪਲ ਔਰ ਜੈਲੋ ਯੀ ਕੈਨ ਈਟ ਸਵੀਟਸ ਪਟੈਟੋ ਹੋਲ ਓਪੀਲੇਟ ਐਂਡ ਦ ਲੈਵਲਸ ਔਫ ਪਲਾਂਟ ਐਨ ਟੈਡੇਵਲ ਦਿਸ ਪੰਜਾਬੀ ਫੂਡ ਮੈਨੀਊ